ਭਾਰਤ ਵਿੱਚ ਬਹੁਤ ਸਾਰੇ ਇੱਦਾਂ ਦੇ ਧਾਰਮਿਕ ਸਥਾਨ ਹਨ ਜਿੱਥੇ ਲੋਕ ਜਾਂਦੇ ਹਨ ਜਿਵੇਂ ਕਿ ਅੰਮ੍ਰਿਤਸਰ ਦਾ ਗੋਲਡਨ ਟੈਂਪਲ ਬਿਹਾਰ ਦਾ ਪਟਨਾ ਸਾਹਿਬ ਗੁਰਦੁਆਰਾ ਦਿੱਲੀ ਦਾ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਵਰਿੰਦਾਵਨ ਦੁਆਰਕਾ ਸੋਮਨਾਥ ਟੈਂਪਲ ਹਰਿਦੁਆਰ ਦਾ ਟੈਂਪਲ ਰਿਸ਼ੀਕੇਸ਼ ਮੰਦਰ ਲਕਸ਼ਮਨ ਝੂਲਾ ਹੋਰ ਵੀ ਕਈ ਇਸ ਤਰ੍ਹਾਂ ਦੇ ਧਾਰਮਿਕ ਸਥਾਨ ਹਨ ਜਿੱਥੇ ਲੋਕ ਜਾਣਾ ਪਸੰਦ ਕਰਦੇ ਹਨ ਇੱਥੇ ਕਾਫੀ ਸਾਰੇ ਕਈ ਸਾਰੇ ਇੱਦਾਂ ਦੇ ਤਿਉਹਾਰ ਹਨ ਜਿਹੜੇ ਕੁਛ ਹੀ ਸਥਾਨਾਂ 'ਤੇ ਬਹੁਤ ਹੀ ਉਹਸ਼ਾਹ ਪੂਰਵਕ ਮਨਾਏ ਜਾਂਦੇ ਹਨ ਜਿਵੇਂ ਕਿ ਹੋਲੀਆਂ ਵਿੱਚ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇੱਥੇ ਫੁੱਲਾਂ ਦੀ ਹੋਲੀ ਖੇਡੀ ਜਾਂਦੀ ਹੈ ਵਰਿੰਦਾਵਨ ਵਿੱਚ ਹਿੰਦੂ ਕਲਚਰ ਦੇ ਵਿੱਚ ਵਰਿੰਦਾਵਨ ਵਿੱਚ ਹੋਲੀ ਬਹੁਤ ਹੀ ਪਿਆਰ ਨਾਲ ਬਹੁਤ ਹੀ ਸਨੇਹ ਪੂਰਵਕ ਮਨਾਈ ਜਾਂਦੀ ਹੈ ਇੱਥੇ ਵੀ ਫੁੱਲਾਂ ਦੀ ਹੋਲੀ ਅਤੇ ਅ ਰੰਗਾਂ ਦੀ ਹੋਲੀ ਵੀ ਖੇਡੀ ਜਾਂਦੀ ਹੈ ਅੰਮ੍ਰਿਤਸਰ ਵਿੱਚ ਦਿਵਾਲੀ ਦਾ ਤਿਉਹਾਰ ਸ਼੍ਰੀ ਹਰਿਮੰਦਰ ਸਾਹਿਬ ਬਹੁਤ ਹੀ ਚਾਅਪੂਰਵਕ ਮਨਾਇਆ ਜਾਂਦਾ ਹੈ ਇੱਕ ਕਹਾਵਤ ਹੈ ਦਾਲ ਰੋਟੀ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ ਇਹ ਕਹਾਵਤ ਇਸੇ ਤਿਉਹਾਰ ਨੂੰ ਦੇਖ ਕੇ ਬਣਾਈ ਗਈ ਹੈ ਕਿਉਂਕਿ ਅੰਮ੍ਰਿਤਸਰ ਦੀ ਦੀਵਾਲੀ ਦੇਖਣਯੋਗ ਹੁੰਦੀ ਹੈ ਇੱਥੇ ਲੋਕ ਦੂਰੋਂ ਦੂਰੋਂ ਆ ਕੇ ਦਿਵਾਲੀ ਮਨਾਉਂਦੇ ਹਨ ਇਹ ਦੀਪ ਮਾਲਾ ਹੁੰਦੀ ਹੈ ਅਤੇ ਰਾਤ ਨੂੰ ਆਤਿਸ਼ਬਾਜ਼ੀ ਕਰਕੇ ਦਿਵਾਲੀ ਦਾ ਤਿਉਹਾਰ ਬੜੀ ਹੀ ਚਾਅ ਪੂਰਵਕ ਮਨਾਇਆ ਜਾਂਦਾ ਹੈ ਹੋਰ ਵੀ ਭਾਰਤ ਵਿੱਚ ਕਈ ਤੀਰਥ ਸਥਾਨ ਹਨ ਜਿੱਥੇ ਜਿੱਥੇ ਤਿਉਹਾਰ ਬਹੁਤ ਹੀ ਪਿਆਰ ਨਾਲ ਅਤੇ ਬਹੁਤ ਹੀ ਚਾਅ ਪੂਰਵਕ ਮਨਾਇਆ ਜਾਂਦਾ ਹੈ